ਪੰਜਾਬ ਵਿੱਚ ਮਨੋਰੰਜਨ ਦੇ ਬਹੁਤ ਸਾਰੇ ਉਦਯੋਗ ਹਨ ਅਤੇ ਇਹਨਾਂ ਉਦਯੋਗਾਂ ਵਿੱਚ ਮੁੱਖ ਤੌਰ 'ਤੇ ਕੰਮ ਕਰਨਾ

ਮਨੋਰੰਜਨ ਦੇ ਬਹੁਤ ਹੀ ਉਦਯੋਗ ਖੁੱਲ੍ਹ ਰਹੇ ਹਨ ਜਿਵੇਂ ਕਿ ਫਨ ਸਿਟੀ ਲਾ ਲਓ ਸਨ ਸਿਟੀ ਲਾ ਲਓ ਇੱਕ ਕਿ ਸਾਇੰਸ ਸਿਟੀ ਆ ਇ ਮਨੋਰੰਜਨ ਦੇ ਇੰਨੇ ਕੁ ਸ ਅ ਉਦਯੋਗ ਖੁੱਲ੍ਹ ਰਹੇ ਹਨ ਕਿ ਇਹਨਾਂ ਨੂੰ ਦੇਖਣ 'ਚ ਲੱਗਦਾ ਹੈ ਕਿ ਬਹੁਤ ਹੀ ਇਜ਼ੀ ਕਿ ਅਸਟੈਬਲਿਸ਼ ਹੋ ਜਾਂਦੇ ਹਨ ਬਹੁਤ ਹੀ ਸੁਖਾਲੇ ਤਰੀਕੇ ਨਾਲ ਇਹਨਾਂ ਉਦਯੋਗਾਂ ਨੂੰ ਆਪਾਂ ਸ਼ੁਰੂ ਕਰ ਸਕਦੇ ਹਾਂ ਪਰ ਅੱਜ ਕੱਲ੍ਹ ਇੰਨਾ ਕੁ ਜ਼ਿਆਦਾ ਕੋਮਪੀਟੀਸ਼ਨ ਹੋ ਗਿਆ ਹੈ ਕਿ ਅੱਜ ਕੱਲ੍ਹ ਜਿੱਥੇ ਵੀ ਕੋਈ ਉਦਯੋਗ ਖੁੱਲ੍ਹਦਾ ਹੈ ਉਹਦੇ ਨਾਲ ਹੀ ਦੂਜਾ ਉਦਯੋਗ ਖੁੱਲ੍ਹ ਜਾਂਦਾ ਹੈ ਉਹਦੇ ਨਾਲ ਹੀ ਮਤਲਬ ਇੰਨਾ ਕੁ ਜ਼ਿਆਦਾ ਕੋਂਪੀਟੀਸ਼ਨ ਹੋ ਗਿਆ ਕਿ ਇੱਕ ਦੂਜੇ ਨੂੰ ਇੱਕ ਕਿਸੇ ਟੈਲੈਂਟ ਦੇ ਬੇਸ 'ਤੇ ਅਗਰ ਕਿਸੇ ਨੂੰ ਕੋਈ ਮੌਕਾ ਦਿੱਤਾ ਜਾਂਦਾ ਹੈ ਤਾਂ ਮਤਲਬ ਮੌਕਾ ਜੇ ਮਿਲਦਾ ਹੈ ਤਾਂ ਉਸਦੀ ਕਾਬਲੀਅਤ ਵੀ ਨਹੀਂ ਦੇਖੀ ਜਾਂਦੀ ਕਿ ਅੱਜ ਕੱਲ੍ਹ ਮੌਕਾ ਮਿਲਣਾ ਬਹੁਤ ਹੀ ਔਖਾ ਹੈ ਮਤਲਬ ਵੀ ਥੋੜ੍ਹੇ ਪੈਸਿਆਂ 'ਚ ਹੀ ਉਸ ਨੂੰ ਕਿ ਮੌਕਾ ਛੱਡਣਾ ਪੈਂਦਾ ਹੈ ਅਤੇ ਉਸਦੀ ਜਗ੍ਹਾ ਕਿਸੇ ਹੋਰ ਨੂੰ ਰੱਖ ਲਿੱਤਾ ਜਾਂਦਾ ਹੈ ਅੱਜ ਕੱਲ੍ਹ ਇਹੀ ਹੀ ਹੋ ਰਿਹਾ ਹੈ ਤੇ ਬਹੁਤ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਕੋਈ ਵੀ ਕੰਮ ਉਦਯੋਗ ਹੈ ਅੱਜ ਕੱਲ੍ਹ ਇਹਦੇ ਵਿੱਚ ਮੀਡੀਆ ਦਾ ਵੀ ਬਹੁਤ ਹੀ ਵੱਡਾ ਰੋਲ ਹੁੰਦਾ ਹੈ ਕਿਉਂਕਿ ਮੀਡੀਆ ਨੂੰ ਸ਼ਬਦਾਂ ਸ਼ਬਦਾਂ ਦੇ ਹੀ ਧਨੀ ਕਿਹਾ ਜਾਂਦਾ ਹੈ ਉਹ ਕਿਸੇ ਵੀ ਚੀਜ਼ ਨੂੰ ਮਤਲਬ ਵੀ ਚੰਗੀ ਨੂੰ ਮਾੜੀ ਵੀ ਕ ਕਹਾ ਦਿੰਦੇ ਹਨ ਅਤੇ ਕ ਮਾੜੀ ਨੂੰ ਵੀ ਚੰਗਿਆ ਦੱਸਣ ਵਿੱਚ ਵੀ ਉਹਨਾਂ ਦਾ ਇੱਕ ਹੱਥ ਹੁੰਦਾ ਜਿਸ ਤਰ੍ਹਾਂ ਬਣੀ ਬਣਾਈ ਚੀਜ਼ ਕਿਸੇ ਦਾ ਕੋਈ ਵੀ ਮ ਉਦਯੋਗ ਜਿਹੜਾ ਹੁੰਦਾ ਵਾ ਇਹ ਕਿਸੇ ਦਾ ਬਣਿਆ ਬਣਿਆ ਉਦਯੋਗ ਵੀ ਠੱਪ ਹੋ ਜਾਂਦਾ ਹੈ ਇਸ ਲਈ ਇੱਕ ਹੀ ਉਦਯੋਗ ਵਿੱਚ ਕੰਮ ਕਰਨਾ ਅੱਜ ਦੇ ਦੌਰ ਵਿੱਚ ਬਹੁਤ ਹੀ ਔਖਾ ਹੈ ਬਹੁਤ ਸਾਰੀਆਂ ਸਾਨੂੰ ਚਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਧੰਨਵਾਦ